ਮੈਂ ਇੱਕ ਗੇਮ ਨੂੰ ਸੋਧਣ ਦੀ ਜਗ੍ਹਾ ਆਪਣੀ ਖੁਦ ਦੀ ਸਮੱਗਰੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਪੰਜਾਬੀ ਵਿੱਚ ਅਕਸਰ ਕਹਿੰਦੇ ਹਾਂ ਆਪਣੇ ਹੱਥ ਆਪਣੇ ਹੀ ਫੁੱਲ ਖੇਡਣ ਇਸ ਲਈ ਜਬ ਤੁਸੀਂ ਇੱਕ ਨਵਾਂ ਗੇਮ ਬਣਾਉਣ ਦੀ ਸੋਚ ਵਿੱਚ ਆਉਂਦੇ ਹੋ ਤੁਸੀਂ ਆਪਣੇ ਵਿਚਾਰ ਤਜ਼ੀਕੀਏ ਅਤੇ ਸਹਿਯੋਗ ਨੂੰ ਇਸਤੇਮਾਲ ਕਰਕੇ ਇੱਕ ਵਿਚਾਰ ਵਰ ਸਮਗਰੀ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਹੁੰਦੀ ਅਸੀਂ ਪੰਜਾਬੀ ਲੋਕ ਬਹੁਤ ਜਜ਼ਬਾਤੀ ਹਾਂ ਅਤੇ ਆਪਣੀ ਕ੍ਰੈਰਟੀਵਿਟੀ ਨੂੰ ਵੱਧ ਤੋਂ ਵੱਧ ਵਰਤ ਕਰਨ ਦੀ ਕੋਸ਼ਿਸ਼ ਕਰਦਿਆਂ ਹਾਂ ਇਸ ਲਈ ਤੁਸੀਂ ਆਪਣੇ ਗੇਮ 'ਚ ਆਪਣੀ ਸੰਸਕ੍ਰਿਤੀ ਲੋਕ ਕਥਾ ਅਤੇ ਸਮਾਜਿਕ ਮੁੱਦੇ ਵੀ ਸ਼ਾਮਿਲ ਕਰ ਸਕਦੇ ਹੋ ਜੋ ਕਿ ਤੁਸੀਂ ਹੋਰ ਕਿਸੇ ਗੇਮ ਵਿੱਚ ਨਹੀਂ ਦੇਖੋਗੇ ਇਤਿਹਾਸ ਵਿੱਚ ਪੰਜਾਬੀ ਲੋਕ ਨੇ ਹਮੇਸ਼ਾ ਨਵੀਆਂ ਆਈਡੀਆਸ 'ਤੇ ਸਮਾਜਿਕ ਤਬਦੀਲੀਆਂ ਦੀ ਪੇਸ਼ਕਸ਼ ਕੀਤੀ ਹੈ ਅਤੇ ਤੁਸੀਂ ਵੀ ਇਸ ਟਰਡੀਸ਼ਨ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ ਹੋਗੀ